ਨਵ ਜੰਮੇ ਬੱਚੇ ਲਈ ਉਸਦੇ ਪਹਿਲੇ ਸਾਲ ਦੇ ਦੌਰਾਨ ਵੱਖ ਵੱਖ ਰਸਮ ਕੀਤੀਆਂ ਜਾਂਦੀਆਂ ਹਨ ਇਹ ਰਸਮਾਂ ਭਾਰਤ ਦੇਸ਼ ਦੇ ਵਿੱਚ ਧਾਰਮਿਕ ਅਤੇ ਸੰਸਕਾਰੀ ਮਹੱਤਤਾ ਰੱਖਦੀਆਂ ਹਨ ਕੁਝ ਮਹੱਤਵਪੂਰਨ ਰਸਮਾਵਾਂ ਇਹ ਹਨ ਪਹਿਲੀ ਨਾਮਕਰਨ ਸੰਸਕਾਰ ਜਿਹਦੇ ਵਿੱਚ ਨਾਮ ਰੱਖਣ ਦੀ ਰਸਮ ਵੀ ਕਿਹਾ ਜਾਂਦਾ ਹੈ ਇਹਦੇ ਵਿੱਚ ਜਨਮ ਤੋਂ ਕੁਝ ਦਿਨ ਬਾਅਦ ਆਮ ਤੌਰ 'ਤੇ ਗੁਰਦੁਆਰੇ ਜਾਂ ਘਰ ਵਿੱਚ ਕੀਰਤਨ ਕਰਵਾ ਕੇ ਗੁਰੂ ਗ੍ਰੰਥ ਸਾਹਿਬ ਤੋਂ ਹੁਕਮਨਾਮਾ ਲਿਆ ਜਾਂਦਾ ਹੈ ਅਤੇ ਹੁਕਮ ਮਾਨੇ ਦੇ ਪਹਿਲੇ ਅੱਥ ਅੱਖਰ ਅਨੁਸਾਰ ਬੱਚੇ ਦਾ ਨਾਮ ਚੁਣਿਆ ਜਾਂਦਾ ਹੈ ਅਤੇ ਦੂਜੀ ਰਸਮ ਇਹ ਹੈ ਅਨਬ੍ਰਸ਼ਨ ਜਿਹੜੇ ਵਿੱਚ ਪਹਿਲੀ ਵਾਰ ਅੰਨ ਖਵਾਉਣ ਦੀ ਰਸਮ ਵੀ ਕਿਹਾ ਜਾਂਦਾ ਹੈ ਜਿਹਦੇ ਵਿੱਚ ਜਦ ਬੱਚਾ ਲਗਭਗ ਛੇ ਮਹੀਨਿਆਂ ਦਾ ਹੁੰਦਾ ਹੈ ਉਸਨੂੰ ਪਹਿਲੀ ਵਾਰ ਦਲੀਆ ਜਾਂ ਖੀਰ ਬੜ ਬਣ ਕੇ ਨਰਮ ਭੋਜਨ ਖਵਾਇਆ ਜਾਂਦੇ ਹਨ ਇਸ ਮੌਕੇ 'ਤੇ ਪਰਿਵਾਰਿਕ ਮੈਂਬਰ ਆਉਂਦੇ ਹਨ ਅਤੇ ਸ਼ੁਭ ਅਸੀਸ ਦਿੰਦੇ ਹਨ ਤੀਸਰਾ ਮੁੰਡਨ ਜਿਹਨੂੰ ਅਸੀਂ ਸਿਰ ਮੁੰਡਵਾਉਣ ਦੀ ਰਸਮ ਵੀ ਕਿਹਾ ਜਾਂਦਾ ਹੈ ਜਿਹਦੇ ਵਿੱਚ ਬੱਚੇ ਦੇ ਪਹਿਲੀ ਵਾਰ ਵਾਲ ਵਧਾਉਣ ਵਧਾਉਣ ਦੀ ਰਸਮ ਆਮ ਤੌਰ 'ਤੇ ਗੁਰਦੁਆਰੇ ਜਾਂ ਤੀਰਥ ਅਸਥਾਨ 'ਤੇ ਕਰਵਾਈ ਜਾਂਦੀ ਹੈ ਅਤੇ ਇਸ ਦਾ ਉਦੇਸ਼ ਬੱਚੇ ਦੀ ਤੰਦਰੁਸਤੀ ਅਤੇ ਭਵਿੱਖ ਚੰਗਾ ਹੋਣ ਦੀ ਕਾਮਨਾ ਕਰਨੀ ਹੁੰਦੀ ਹੈ ਤੀਸਰੀ ਪਹਿਲੀ ਵਾਰ ਗੁਰਦੁਆਰਾ ਜਾਣਾ ਇਹਦੇ ਵਿੱਚ ਬੱਚੇ ਨੂੰ ਪਹਿਲੀ ਵਾਰ ਗੁਰਦੁਆਰੇ ਦੇ ਜਾਣ ਇੱਕ ਮਹੱਤਵਪੂਰਨ ਪਰੰਪਰਾ ਮੰਨੀ ਜਾਂਦੀ ਹੈ